ਹਾਂਜੀ ਹੈਲੋ ਹਾਂਜੀ ਹਾਂਜੀ ਸਰਬਜੀਤ ਸਿੰਘ ਬੋਲਦਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ

ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅਤੇ ਕਿੰਨੇ ਰੋਲ ਨੰਬਰ ਕਿੰਨਾ ਜੀ ਚੱਲੋ ਨੰਬਰ ਬਾਰਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਪਿੱਛੇ ਜਿਹੇ ਹੋਏ ਜੂਨੀਅਰ ਟੈਸਟ ਹੋਏ ਹੈ ਅਤੇ ਇੱਕ ਮਿੰਟ ਇੱਕ ਇੱਕ ਮਿੰਟ ਮੈਂ ਦੇਖਦਾ ਮੈਂ ਕੱਢਦਾ ਰੋਲ ਨੰਬਰ ਬਾਰਾਂ ਹਾਂਜੀ ਹਾਂਜੀ ਰੋਲ ਨੰਬਰ ਬਾਰਾਂ ਭੁਪਿੰਦਰ ਸਿੰਘ ਠੀਕ ਹੈ ਜੀ ਅਤੇ ਬੇਟਾ ਤੁਹਾਡਾ ਇੰਗਲਿਸ਼ ਤਾਂ ਇੰਗਲਿਸ਼ ਵਿੱਚ ਪਾਸ ਹੋ ਗਿਆ ਪਰ ਨੰਬਰ ਥੋੜ੍ਹੇ ਘੱਟ ਹੈ ਅਤੇ ਮੈਥ ਵਿੱਚ ਵੀ ਮੁੰਡਾ ਤੁਹਾਡਾ ਮੈਥ ਵਿੱਚ ਤਾਂ ਠੀਕ ਹੈ ਥੋੜ੍ਹੇ ਜਿਹੇ ਪੰਜਾਬੀ ਵਿੱਚ ਵੀ ਪੰਜਾਬੀ 'ਚ ਵੀ ਨੰਬਰ ਘੱਟ ਹੈ ਜੀ ਇਹਦੇ ਹਾਂਜੀ ਹਾਂਜੀ ਕੀ ਕੀ ਅਸੀਂ ਅਦਲਾ ਬਦਲੀ ਅਸੀਂ ਕਰਦੇ ਰਹਿੰਦੇ ਹਾਂ ਅਸੀਂ ਬੱਚਿਆਂ ਦੀ ਨਾ ਰੋਟੀਨ ਵੀਕਲੀ ਅਸੀਂ ਸ਼ਫਲਿੰਗ ਕਰਦੇ ਰਹਿੰਦੇ ਹਾਂ ਵੀ ਜਿੱਦਾਂ ਬੈਂਚ 'ਤੇ ਬੱਚੇ ਬਹਿੰਦੇ ਹੈ ਨਾ ਵੀ ਅੱਜ ਇਹਨੇ ਇੱਥੇ ਬੈਠਣਾ ਅੱਗੇ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ ਹੁੰਦਾ ਰਹਿੰਦਾ ਇਹਦੇ ਨਾਲ ਨਾ ਜਿੱਦਾਂ ਹੁਣ ਇੰਗਲਿਸ਼ ਵਿੱਚ ਹੈ ਅੱਜ ਕੱਲ੍ਹ ਹੁਣ ਅੱਗੇ ਜ਼ਮਾਨਾ ਇੰਗਲਿਸ਼ ਦਾ ਹੀ ਆ ਰਿਹਾ ਹੈ ਨਾ ਥੋੜ੍ਹਾ ਜਿਹਾ ਇੰਗਲਿਸ਼ ਵਿੱਚ ਤੁਸੀਂ ਵੀ ਘਰ ਥੋੜ੍ਹਾ ਜਿਹਾ ਧਿਆਨ ਦਿਉ ਹੈ ਨਾ ਇੰਗਲਿਸ਼ ਵੱਲ ਜਦ ਜਦ ਬੱਚਾ ਰੀਡਿੰਗ ਕਰੇ ਹੈ ਨਾ ਬਾਕੀ ਪੰਜਾਬੀ ਹੈ ਚੱਲੋ ਆਪਾਂ ਪੰਜਾਬ 'ਚ ਰਹਿੰਦੇ ਹਾਂ ਪੰਜਾਬੀ ਤਾਂ ਆਉਣੀ ਚਾਹੀਦੀ ਹੈ ਮੈਨੂੰ ਇਹ ਵੀ ਪੰਜਾਬ ਪੰਜਾਬ ਪੰਜਾਬੀ ਵਿੱਚ ਇਹਦੇ ਨੰਬਰ ਕਿੱਦਾਂ ਘੱਟ ਹੈ ਪਰ ਪੰਜਾਬੀ ਵਿੱਚ ਵੀ ਜਿੱਦਾਂ ਹੁਣ ਆਪਣੇ ਘਰ ਅਖ਼ਬਾਰ ਲੱਗਿਆ ਹੋਇਆ ਹੈ ਨਾ ਫੇਰ ਜਦ ਬੈਠਦੇ ਹਾਂ ਸਕੂਲ ਆਉਣ ਤੋਂ ਪਹਿਲਾਂ ਇਹਨੂੰ ਅਖ਼ਬਾਰ ਜਦੋਂ ਤੁਸੀਂ ਪੜ੍ਹਦੇ ਹੋਊਂਗੇ ਘਰ ਵਿੱਚ ਅਖ਼ਬਾਰ ਇਹ ਨੂੰ ਵੀ ਨਾਲ ਜਿੱਦਾਂ ਕਹਿ ਦਿੱਤਾ ਵੀ ਜੇ ਹਾਂ ਬਈ ਆਹ ਖਬਰ ਮੈਨੂੰ ਪੜ੍ਹ ਕੇ ਸੁਣਾ ਹੈ ਨਾ ਪੜ੍ਹਕੇ ਸੁਣਾ ਇੱਦਾਂ ਦੀ ਜਦੋਂ ਜਦੋਂ ਇੱਦਾਂ ਦੀ ਰੀਡਿੰਗ ਕਰੇਗਾ ਨਾ ਅਤੇ ਇਹਦੀ ਆਟੋਮੈਟਿਕ ਪੰਜਾਬੀ ਇਹਦੀ ਬਿਲਕੁਲ ਇਹ ਵੀ ਅੱਪ ਹੋ ਜਾਣੀ ਹੈ ਅਤੇ ਰੀਡਿੰਗ ਥੋੜ੍ਹੀ ਜਿਹੀ ਕਮਜ਼ੋਰ ਲੱਗਦੀ ਹੈ ਮੈਂਨੂੰ ਇਹਦੇ ਵੱਲ ਤੁਹਾਨੂੰ ਧਿਆਨ ਦੇਣਾ ਪੈਣਾ ਹਾਂ ਨਹੀਂ ਖੇਡਾਂ ਸਾਡੇ ਹੁਣ ਤਾਂ ਇੱਥੇ ਪੀ ਟੀ ਪੀਰੀਅਡ ਲੱਗਦੇ ਹੈ ਪੀ ਟੀ ਪੀਰੀਅਡ ਵਿੱਚ ਬੱਚੇ ਖੇਡਦੇ ਹੈ ਪਰ ਜੇ ਹੋ ਸਕਦਾ ਜੇ ਤੁਹਾਡੇ ਕੋਲ ਟਾਈਮ ਹੈਗਾ ਹੈ ਜਾਂ ਅੱਵਲ ਮੇਂ ਤਾਂ ਦਸਵੀਂ ਕਲਾਸ ਦਾ ਬੱਚਾ ਹੈ ਠੀਕ ਹੈ ਸਾਈਕਲ ਵੀ ਚਲਾ ਸਕਦਾ ਹੈ ਜਾਂ ਤੁਹਾਡੇ ਘਰ ਸਕੂਟਰੀ ਹੋਏਗੀ ਹੈ ਨਾ ਕਿੰਨ੍ਹਾ ਚਾਰ ਪੰਜ ਕਿਲੋਮੀਟਰ ਸਕੂਲ ਹੈਗਾ ਤੁਹਾਡੇ ਘਰ ਤੋਂ ਸ਼ਾਮ ਨੂੰ ਸਾਡੇ ਇੱਥੇ ਪੀ ਟੀ ਮਾਸਟਰ ਆਉਂਦੇ ਹੈ ਗਰਾਊਂਡ ਵਿੱਚ ਅਤੇ ਤੁਸੀਂ ਆਪਣਾ ਜਿੱਦਾਂ ਬੱਚੇ ਨੂੰ ਭੇਜੋ ਚਾਹੇ ਤੁਸੀਂ ਆਪ ਆ ਕੇ ਸੈਰ ਕਰ ਲਈ ਹੈ ਨਾ ਇੱਥੇ ਬੱਚੇ ਫੁੱਟਬਾਲ ਵੀ ਖੇਡਦੇੇ ਹੈ ਰਨਿੰਗ ਵੀ ਕਰਦੇ ਹੈ ਸਾਰਾ ਕੁਝ ਹੁੰਦਾ ਤੁਸੀਂ ਇਕ ਫਿਜ਼ੀਕਲ ਫਿੱਟ ਰਹੂਗਾ ਬੱਚਾ ਆਪਣਾ ਹੈ ਨਾ ਇੱਕ ਮੋਬਾਈਲ ਤੋਂ ਥੋੜ੍ਹਾ ਜਿਹਾ ਛੋੜੂਗਾ ਜਿੱਦਾਂ ਅੱਜ ਕੱਲ੍ਹ ਦਾ ਟ੍ਰੈਂਡ ਹੈ ਬੱਚੇ ਮੋਬਾਈਲ ਹੀ ਨਹੀਂ ਛੱਡਦੇ ਹੈ ਨਾ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ